ਮੈਂ ਆਪਣੇ ਬੀ ਬਗੀਚੇ ਦੀ ਸਾਂਭ ਸੰਭਾਲ ਲਈ ਹਮੇਸ਼ਾ ਦੇਸੀ ਖਾਦ ਦਾ ਇਸਤੇਮਾਲ ਕਰਦਾ ਹੁੰਦਾ ਸੀ ਅਤੇ ਉਹਦੀ ਗੁਡ ਗੁਡਾਈ ਕਰਦਾ ਸੀ ਲੇਕਿਨ ਕੀੜੇ ਮਕੌੜੇ ਤੋਂ ਬਚਣ ਲਈ ਅਸੀਂ ਡੀ ਡੀ ਟੀ ਦੀ ਸਪਰੇਅ ਕਰਦੇ ਸੀ ਅਤੇ ਨਿੰਮ ਦੇ ਪਾਣੀ ਦਾ ਛਿੜਕਾਓ ਕਰਦੇ ਸੀ ਤਾਂ ਕਿ ਜੋ ਸਾਡਾ ਬਗੀਚੇ ਦੇ ਵਿੱਚ ਬੂਟਾ ਲੱਗਿਆ ਹੋਇਆ ਉਹ ਰਾਜ਼ੀ ਰਹੇ